ਭੰਗੜਾ ਪੰਜਾਬ ਦਾ ਇੱਕ ਪ੍ਰਸਿੱਧ ਲੋਕ ਨਾਚ ਹੈ ਇਸ ਵਿੱਚ ਢੋਲ ਦੀ ਵਰਤੋਂ ਕੀਤੀ ਜਾਂਦੀ ਹੈ ਢੋਲ ਤੋਂ ਇਲਾਵਾ ਹੋਰ ਵੀ ਕਈ ਪ੍ਰਕਾਰ ਦੇ ਸੰਦ ਇਸ ਵਿੱਚ ਵਰਤੇ ਜਾਂਦੇ ਹਨ ਜਿਵੇਂ ਕਾਟੋ ਚਿਮਟਾ ਬੁਗਚੂ ਡਾਂਗ ਆਦਿ ਭੰਗੜਾ ਪੰਜਾਬ ਦੇ ਮੁੱਖ ਅਤੇ ਉੱਘੇ ਲੋਕ ਨਾਚਾਂ ਵਿੱਚੋਂ ਇੱਕ ਆ ਦੂਜਾ ਮੁੱਖ ਨਾਚ ਗਿੱਧਾ ਹੈ ਭੰਗੜਾ ਗੱਭਰੂਆਂ ਦਾ ਨਾਚ ਹੈ ਜਦਕਿ ਗਿੱਧਾ ਇਸਦਾ ਫੀਮੇਲ ਵਰਜਨ ਆ ਭੰਗੜਾ ਤਕਰੀਬਨ ਹਰ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂ ਨੱਚਿਆ ਜਾਂਦਾ ਹੈ ਜਿਨ੍ਹਾਂ ਵਿੱਚ ਕਣਕ ਦੀ ਵਾਢੀ ਭਾਵ ਵਿਸਾਖੀ ਆਦਿ ਮੇਲੇ ਵਿਆਹ ਮੰਗਣੇ ਅਤੇ ਤਿਉਹਾਰ ਸ਼ਾਮਿਲ ਹੁੰਦੇ ਆ ਲੋਕ ਧਾਰਾ ਵੀ ਗਿਆਨੀ ਸੋਹਿੰਦਰ ਸਿੰਘ ਵਣਜਾਰਾ ਬੇਦੀ ਦੇ ਸ਼ਬਦਾਂ ਵਿੱਚ ਪਹਿਲਾਂ ਪਹਿਲਾਂ ਜਦੋਂ ਪੰਜਾਬ ਦੇ ਹਰੀਆਂ ਫਸਲਾਂ ਨੂੰ ਸੁਨਹਿਰੀ ਸਿੱਟੇ ਪੈਂਦੇ ਵੇਖੇ ਤਾਂ ਉਹਨਾਂ ਦਾ ਮਨ ਹੁਲਾਰੇ ਵਿੱਚ ਆ ਕੇ ਨੱਚ ਖਲੋਤਾ ਲੰਮੀ ਘਾਲਣਾ ਅਤੇ ਕਰੜੀ ਮਿਹਨਤ ਨੂੰ ਸੁਨਹਿਰੀ ਫਲ ਲੱਗਿਆ ਵਿਆ ਕਿਸੇ ਦਾ ਦਿਲ ਵੀ ਨਹੀਂ ਨੱਚ ਉੱਠਦਾ ਮੁੱਢ ਵਿੱਚ ਇਹ ਨਾਚ ਫਸਲਾਂ ਦੀ ਉਪਜਾਊ ਸ਼ਕਤੀ ਵਧਾਉਣ ਲਈ ਕੀਤੀਆਂ ਰੀਤੀ ਰਸਮਾਂ ਸਮੇਂ ਖੁੱਲ੍ਹੇ ਖੇਤਾਂ ਵਿੱਚ ਨੱਚਿਆ ਜਾਂਦਾ ਸੀ ਪ੍ਰੰਤੂ ਹੁਣ ਇਸ ਨੂੰ ਵਿਆਹ ਸ਼ਾਦੀਆਂ ਦੇ ਮੌਕੇ ਵੀ ਪਾਇਆ ਜਾਂਦਾ ਹੈ ਬੋਲੀਆਂ ਕਈ ਪ੍ਰਕਾਰ ਦੀਆਂ ਪਾਈਆਂ ਜਾਂਦੀਆਂ ਹਨ ਬੋਲੀਆਂ ਆਮ ਤੌਰ 'ਤੇ ਢੋਲੀ ਵੱਲੋਂ ਹੀ ਪਾਈਆਂ ਜਾਂਦੀਆਂ ਹਨ ਪਰੰਤੂ ਅਜੋਕੇ ਸਮੇਂ ਵਿੱਚ ਭੰਗੜਾ ਨਾ ਕੇਵਲ ਬੋਲੀਆਂ 'ਤੇ ਬਲਕਿ ਪੰਜਾਬੀ ਗੀਤਾਂ 'ਤੇ ਵੀ ਪਾਇਆ ਜਾਣ ਲੱਗਾ ਹੈ ਪੰਜਾਬੀ ਭੰਗੜੇ ਅਹਿਮੀਅਤ ਰੱਖਦਾ ਹੈ ਪੰਜਾਬ ਦੇ ਲੋਕ ਨਾਚਾਂ ਵਿੱਚ ਅਹਿਮੀਅਤ ਰੱਖਦਾ ਹੈ ਤਿਉਹਾਰ ਦਾ ਇੱਕ ਮਹੱਤਵਪੂਰਨ ਹਿੱਸਾ ਬਣਿਆ ਹੋਇਆ ਹੈ ਭੰਗੜਾ ਵਿਸਾਖੀ ਦੇ ਤਿਉਹਾਰ ਦਾ ਇੱਕ ਮਹੱਤਵਪੂਰਨ ਹਿੱਸਾ ਬਣਿਆ ਹੋਇਆ ਵਿਸਾਖੀ ਦੇ ਤਿਉਹਾਰ ਨੂੰ ਜਦੋਂ ਪੰਜਾਬ ਦੇ ਕਿਸਾਨ ਆਪਣੀਆਂ ਫਸਲਾਂ ਵੱਢ ਕੇ ਮੁੱਲ ਵੇਚ ਵੱਟ ਕੇ ਵਿਹਲੇ ਹੋ ਕੇ ਵਿਸਾਖੀ ਦੇ ਮੇਲੇ ਦੇਖਣ ਜਾਂਦੇ ਹਨ ਤਾਂ ਭੰਗੜਾ ਪਾ ਕੇ ਆਪਣੀ ਖੁਸ਼ੀ ਨੂੰ ਆਪਣੀ ਖੁਸ਼ੀ ਨੂੰ ਵਧਾਉਂਦੇ ਹਨ ਅਤੇ ਲੋਕਾਂ ਅੱਗੇ ਪੇਸ਼ ਕਰਦੇ ਹਨ ਪੰਜਾਬ ਦੇ ਗੱਭਰੂ ਬੜੇ ਚਾਵਾਂ ਦੇ ਨਾਲ ਭੰਗੜਾ ਪਾਉਂਦੇ ਰਹੇ ਹਨ ਪੁਰਾਣਿਆਂ ਸਮਿਆਂ ਤੋਂ ਹੀ ਭੰਗੜੇ ਦੀ ਇੱਕ ਅਹਿਮੀਅਤ ਪੰਜਾਬੀ ਲੋਕ ਨਾਚਾਂ ਵਿੱਚ ਦੇਖੀ ਜਾਂਦੀ ਹੈ ਇਹ ਪੰਜਾਬ ਦੇ ਪ੍ਰਸਿੱਧ ਲੋਕਾਂ ਨ ਨਾਚਾਂ ਵਿੱਚੋਂ ਇੱਕ ਹੈ ਭੰਗੜਾ ਤਾਂ ਹਰ ਕਿਸੇ ਕਈ ਤਰ੍ਹਾਂ ਦਾ ਹੁੰਦਾ ਹੈ ਜਿਵੇਂ ਲੁੱਡੀ ਝੂਮਰ ਇਹ ਕਈ ਪ੍ਰਕਾਰ ਦੇ ਨਾਚ ਹਨ ਇਹ ਵੀ ਭੰਗੜੇ ਤੋਂ ਹੀ ਉਤਪੰਨ ਹੋਏ ਹਨ ਭੰਗੜਾ ਪੰਜਾਬ ਦੇ ਗੱਭਰੂ ਛਾਲਾਂ ਮਾਰ ਕੇ ਵੀ ਪਾਉਂਦੇ ਹਨ ਲੱਤਾਂ ਚੱਕ ਕੇ ਵੀ ਪਾਉਂਦੇ ਹਨ ਕੁੜੀਆਂ ਵੀ ਭੰਗੜਾ ਪਾਉਂਦੀਆਂ ਹਨ ਜਿਨ੍ਹਾਂ ਨੂੰ ਗਿੱਧਾ ਕਿਹਾ ਜਾਣ ਲੱਗਾ ਹੈ ਗਿੱਧਾ ਕੁੜੀਆਂ ਵੱਲੋਂ ਪਾਇਆ ਜਾਂਦਾ ਇਹ ਵੀ ਭੰਗੜੇ ਦੇ ਵਾਂਗੂ ਹੀ ਪਾਇਆ ਜਾਂਦਾ ਹੈ ਇਸ ਵਿੱਚ ਕੁੜੀਆਂ ਪਾਉਂਦੀਆਂ ਹਨ ਕੁੜੀਆਂ ਵੀ ਬੋਲੀਆਂ ਪਾਉਂਦੀਆਂ ਹਨ ਬੋਲੀਆਂ ਦੇ ਨਾਲ ਨਾਲ ਭੰਗੜਾ ਪੈਂਦਾ ਹੈ ਢੋਲੀ ਗਿੱਧੇ ਵਿੱਚ ਵੀ ਆਪਣਾ ਪ੍ਰਦਰਸ਼ਨ ਕਰਦਾ ਹੈ ਇਸ ਵਿੱਚ ਵੀ ਆਮ ਤੌਰ 'ਤੇ ਉਹੀ ਸੰਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਹੜੀ ਭੰਗੜੇ ਵਿੱਚ ਕੀਤੀ ਜਾਂਦੀ ਹੈ ਜਿਵੇਂ ਕਾਟੋ ਚਿਮਟਾ ਬੁਗਝੂ ਡਾਂਗ ਕੁੜੀਆਂ ਕਈ ਵਾਰ ਚਰਖੇ ਦੀ ਵੀ ਵਰਤੋਂ ਇਸ ਵਿੱਚ ਕਰਦੀਆਂ ਹਨ ਭੰਗੜਾ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਹੈ ਪੰਜਾਬ ਦੇ ਲੋਕ ਪੁਰਾਣੇ ਸਮਿਆਂ ਤੋਂ ਹੀ ਭੰਗੜੇ ਨੂੰ ਬਹੁਤ ਪਸੰਦ ਕਰਦੇ ਹਨ ਪੰਜਾਬ ਵਿੱਚ ਹਰ ਮੇਲਾ ਤਿਉਹਾਰ ਵਿਆਹ ਕੋਈ ਵੀ ਖੁਸ਼ੀ ਦਾ ਫੰਕਸ਼ਨ ਹੋਵੇ ਭੰਗੜੇ ਤੋਂ ਬਿਨਾ ਅਧੂਰਾ ਮੰਨਿਆ ਜਾਂਦਾ ਭੰਗੜਾ ਪਾਉਣਾ ਪੰਜਾਬ ਦੇ ਗੱਭਰੂਆਂ ਦਾ ਸ਼ੌਕ ਹੈ ਪੰਜਾਬੀ ਆਪਣੇ ਸ਼ੌਕ ਲਈ ਜਾਣੇ ਜਾਂਦੇ ਹਨ ਭੰਗੜਾ ਪਾਉਣ ਵਾਲਾ ਵਿਅਕਤੀ ਉੱਦਾਂ ਵੀ ਫਿਟ ਰਹਿੰਦਾ ਸਾਨੂੰ ਸਾਰਿਆਂ ਨੂੰ ਪੰਜਾਬੀ ਹੋਣ ਦੇ ਨਾਤੇ ਭੰਗੜਾ ਸਿੱਖਣਾ ਚਾਹੀਦਾ ਪੁਰਾਣੇ ਸਮਿਆਂ ਵਿੱਚ ਕੋਲਜ ਦੇ ਟਾਈਮ 'ਚ ਮੈਂ ਵੀ ਭੰਗੜਾ ਪਾਉਂਦਾ ਰਿਹਾ ਹਾਂ ਭੰਗੜੇ ਦੀ ਟੀਮ ਵਿੱਚ ਮੇਰੇ ਮੈਂ ਵੀ ਕਈ ਵਾਰ ਹਿੱਸਾ ਲਿਆ ਭੰਗੜੇ ਦੀ ਡਰੈਸ ਬੜੀ ਮਨ ਨੂੰ ਭਾਉਂਦੀ ਹੈ ਜਦੋਂ ਵੀ ਸਟੇਜ 'ਤੇ ਚੜ੍ਹਦੇ ਹਾਂ ਤਾਂ ਇੱਕ ਅਜੀਬ ਹੀ ਟੈਲੈਂਟ ਅਤੇ ਹੁਨਰ ਆਪਣੇ ਆਪ ਵਿੱਚ ਦੇਖਣ ਨੂੰ ਮਿਲਦਾ ਹੈ ਭੰਗੜਾ ਤਾਂ ਪੰਜਾਬੀਆਂ ਨੂੰ ਉਤਸ਼ਾਹ ਦੇ ਨਾਲ ਭਰ ਦਿੰਦਾ ਹੈ